ਤੀਹ ਮਾਰਚ ਉੱਨੀ ਸੌ ਇਕੱਤਰ ਪੰਦਰਾਂ ਅਗਸਤ ਉੱਨੀ ਸੌ ਸੰਨਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕ ਫਰਵਰੀ ਉੱਨੀ ਸੌ ਤੇਹੱਤਰ ਨੌ ਮਈ ਉੱਨੀ ਸੌ ਛਿਆਨਵੇਂ